ਜਿਵੇਂ ਕਿ ਮੈਂ ਬੀ ਏ ਯਾਨੀ ਕਿ ਬੈਚਲਰਸ ਅੋਫ ਆਰਟਸ ਦੀ ਸਟੂਡੈਂਟ ਹਾਂ ਮੇਰੇ ਪੰਜ ਸਬਜੈਕਟਸ ਦੇ ਵਿੱਚੋਂ ਮੇਰੇ ਕੋਲ ਇੱਕ ਸਬਜੈਕਟ ਫਾਇਨ ਆਰਟਸ ਵੀ ਹੈ ਅਤੇ ਉਸ ਦੇ ਵਿੱਚ ਸਾਨੂੰ ਡਰੋਇੰਗ ਪੇਂਟਿੰਗ ਅਤੇ ਥਿਓਰੀ ਦੇ ਨਾਲ ਨਾਲ ਸਕਲਪਟਿੰਗ ਵੀ ਸਿਖਾਈ ਜਾਂਦੀ ਹੈ ਆਮ ਤੌਰ 'ਤੇ ਸਕਲਪਟਿੰਗ ਸਕਲਪਚਰਸ ਬਣਉਣ ਦੇ ਆਰਟ ਨੂੰ ਕਿਹਾ ਜਾਂਦਾ ਹੈ ਅਤੇ ਇਹ ਅਕਸਰ ਮਡ ਯਾਨੀ ਕਿ ਵੈਟ ਮਡ ਯਾਨੀ ਕਿ ਮਿੱਟੀ ਜਾਂ ਕਲੇਅ ਦੇ ਨਾਲ ਕੀਤਾ ਜਾਂਦਾ ਹੈ ਪਰ ਅਸੀਂ ਜਿਹੜੇ ਸਕਲਪਚਰਸ ਨੇ ਇਸ ਵਾਰ ਯੂਥ ਫੈਸਟੀਵਲ ਦੇ ਲਈ ਬਣਾਏ ਅਤੇ ਅਸੀਂ ਉਹਨਾਂ ਨੂੰ ਮਿੱਟੀ ਜਾਂ ਕਲੇਅ ਦੇ ਨਾਲ ਨਹੀਂ ਅਸੀਂ ਉਹਨਾਂ ਨੂੰ ਵੇਸਟ ਮਟੀਰੀਅਲਸ ਦੇ ਨਾਲ ਨਿਊਜ਼ ਪੇਪਰਸ ਦੇ ਨਾਲ ਟਿਸ਼ੂਸ਼ ਦੇ ਨਾਲ ਬਣਾਇਆ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਸਾਡੀ ਪ੍ਰੇਰਨਾ ਦੀ ਤਾਂ ਉਹ ਸਾਡੇ ਟੀਚਰ ਵੱਲੋਂ ਸਾਨੂੰ ਦਿੱਤੀ ਗਈ ਸੀ ਅਤੇ ਟੋਪਿਕ ਸਾਡਾ ਸੀਗਾ ਅਰਥ ਲੇਟਲੀ ਉਹਦਾ ਮਤਲਬ ਵੀ ਸਾਡੀ ਅਰਥ ਜਿਹੜੀ ਹੈ ਧਰਤੀ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਇਸ ਵਕਤ ਇਫੈਕਟਿਡ ਹੈ ਮਨੁੱਖ ਵੱਲੋਂ ਕੀਤੀਆਂ ਜਾ ਰਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਦੇ ਕਾਰਨ ਅਤੇ ਇਸ ਟੋਪਿਕ ਨੂੰ ਲੈ ਕੇ ਇਹ ਸੋਚ ਨੂੰ ਲੈ ਅਸੀਂ ਬਹੁਤ ਸਾਰੇ ਸਕਲਪਚਰਸ ਅਤੇ ਮੋਡਲਸ ਤਿਆਰ ਕੀਤੇ ਵੇਸਟ ਮਟਰੀਅਲਸ ਦੇ ਨਾਲ ਅਤੇ ਗੱਲ ਕੀਤੀ ਜਾਵੇ ਆਉਣ ਵਾਲੀਆਂ ਚਣੌਤੀਆਂ ਦੀ ਤਾਂ ਉਹ ਇਹ ਸੀ ਕਿ ਕਿਉਂਕਿ ਅਸੀਂ ਪਹਿਲਾਂ ਕਦੇ ਸਕਲਪਚਰ ਬਹੁਤੇ ਬਹੁਤੇ ਨਹੀਂ ਬਣਾਏ ਸੀ ਪ੍ਰੈਕਟਿਸ ਨਹੀਂ ਕੀਤੀ ਸੀ ਤਾਂ ਸਾਨੂੰ ਸਾਈਜ਼ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀ ਜਿਵੇਂ ਕਈ ਵਾਰ ਹੱਥ ਦਾ ਸਾਈਜ਼ ਜਾਂ ਬਾਂਹ ਦਾ ਸਾਈਜ਼ ਮੂੰਹ ਤੋਂ ਵੱਡਾ ਹੋ ਜਾਣਾ ਕਦੇ ਧੜ ਲੱਤਾਂ ਤੋਂ ਛੋਟਾ ਹੋ ਜਾਣਾ ਜਾਂ ਫਿਰ ਕਦੇ ਕੋਈ ਚੀਜ਼ ਬਣਾ ਰਹੇ ਆ ਤਾਂ ਉਹਦਾ ਪ੍ਰਪੋਸ਼ਨ ਗਲਤ ਹੋ ਜਾਣਾ ਉਸ ਤੋਂ ਇਲਾਵਾ ਕੁਛ ਮਟੀਰੀਅਲਜ਼ ਦੇ ਉੱਤੇ ਪੇਂਟ ਕਰਨਾ ਕੁਛ ਕੋਰਨਰਸ ਦੇ ਵਿੱਚ ਜਾਂ ਕੁਛ ਡੀਟੇਲਿੰਗ ਦੇਣੀਆਂ ਕਈ ਵਾਰ ਬਹੁਤ ਮੁਸ਼ਕਿਲ ਹੋ ਜਾਂਦੀਆਂ ਸੀ ਅਤੇ ਕੁਝ ਚੀਜ਼ਾਂ ਐਸੀਆਂ ਸੀ ਜਿਹੜੀਆਂ ਅਸੀਂ ਅੰਨ ਡੂ ਨਹੀਂ ਕਰ ਪਾਉਂਦੇ ਸੀ ਯਾਨੀ ਕਿ ਇੱਕ ਵਾਰ ਅਸੀਂ ਕਰਲੀਆਂ ਹੋਣ ਤਾਂ ਅਸੀਂ ਉਹਨਾਂ ਨੂੰ ਦੁਬਾਰਾ ਨਹੀਂ ਕਰ ਪਾਉਂਦੇ ਸੀ ਤਾਂ ਇਹਨਾਂ ਚਣੌਤੀਆਂ ਦਾ ਸਾਨੂੰ ਜਿਹੜਾ ਹੈ ਸਾਹਮਣਾ ਕਰਨਾ ਪਿਆ ਸੀ